ਸਾਡੇ ਭਾਈਚਾਰੇ ਵਿੱਚ ਪ੍ਰਸਿੱਧ ਭਾਈਚਾਰਕ ਸਮਾਗਮ ਬਹੁਤ ਸਾਰੇ ਆ ਅਲੱਗ ਅਲੱਗ ਤਿਉਹਾਰਾਂ 'ਤੇ ਅਲੱਗ ਅਲੱਗ ਮੌਕਿਆਂ 'ਤੇ ਲੋਕ ਇਕੱਠੇ ਹੁੰਦੇ ਆ ਅਤੇ ਬਹੁਤ ਸਾਰੀ ਪਾਰਟੀ ਕਰਦੇ ਹਨ ਜਾਂ ਫਿਰ ਉਹ ਨਿਊ ਈਅਰ ਦੀ ਪਾਰਟੀ ਹੋਵੇ ਜਾਂ ਫਿਰ ਹੋਲੀ ਜਾਂ ਦਿਵਾਲੀ ਦੀ ਪਾਰਟੀ ਹੋਵੇ ਨਿਊ ਈਅਰ ਦੀ ਪਾਰਟੀ 'ਤੇ ਸਾਡਾ ਪੂਰਾ ਮੁਹੱਲਾ ਇਕੱਠੇ ਹੋ ਕੇ ਬਹੁਤ ਪਾਰਟੀ ਕਰਦਾ ਹੈ ਬਹੁਤ ਨੱਚਦਾ ਹੈ ਬਹੁਤ ਖਿਲਦਾ ਹੈ ਬਹੁਤ ਨੱਚਦਾ ਹੈ ਵੱਖ ਵੱਖ ਪ੍ਰਕਾਰ ਦੀ ਪਾਰਟੀਆਂ ਕਰਨ ਦੇ ਤਾਂ ਸਾਨੂੰ ਮੌਕੇ ਚਾਹੀਦੇ ਹਨ ਦਿਵਾਲੀ ਦੀ ਪਾਰਟੀ 'ਤੇ ਤਾਂ ਔਰ ਵੀ ਜ਼ਿਆਦਾ ਮਜਾ ਆਉਂਦਾ ਹੈ ਸਾਰੇ ਭਾਈ ਬੰਦੂ ਇਕੱਠੇ ਹੋ ਕੇ ਨੱਚਦੇ ਹਨ ਇੱਕ ਦੂਜੇ ਨੂੰ ਗਿਫਟਸ ਦਿੰਦੇ ਹਨ ਅਤੇ ਬਹੁਤ ਨੱਚਦੇ ਹਨ ਬੱਚੇ ਪਟਾਕੇ ਫੋੜਦੇ ਹਨ ਅਤੇ ਘਰਾਂ ਵਿੱਚ ਪੂਜਾ ਹੁੰਦੀ ਹੈ ਸਭ ਸਾਰਿਆਂ ਦੇ ਘਰ ਸਜੇ ਹੁੰਦੇ ਨੇ ਸਾਰਾ ਭਾਈਚਾਰਾ ਇਕੱਠੇ ਹੋ ਕੇ ਇਕੱਠੇ ਰਹਿੰਦਾ ਹੈ ਇਕੱਠੇ ਖੇਡਦਾ ਹੈ ਇਕੱਠੇ ਖੁਸ਼ ਹੁੰਦਾ ਹੈ ਇਸ ਤਰ੍ਹਾਂ ਹੀ ਬਾਕੀ ਵੱਖ ਵੱਖ ਪ੍ਰਕਾਰ ਦੇ ਤਿਉਹਾਰ ਮਨਾਏ ਜਾਂਦੇ ਹਨ ਅਤੇ ਉਨ੍ਹਾਂ ਦੇ ਅਲੱਗ ਅਲੱਗ ਸਮਾਗਮ ਹੁੰਦੇ ਹਨ ਕਦੇ ਕੋਈ ਸੰਤ ਸਾਡੇ ਮੁਹੱਲੇ ਵਿੱਚ ਆਉਂਦਾ ਹੈ ਤਾਂ ਸਾਰੇ ਇਕੱਠੇ ਹੋ ਕੇ ਉਹਦੇ ਪ੍ਰਵਚਨ ਸੁਣਦੇ ਹਨ ਇੱਕ ਸਮਾਗਮ ਹੋਲੀ ਦਾ ਵੀ ਬਹੁਤ ਵਧੀਆ ਹੁੰਦਾ ਹੈ ਹੋਲੀ ਦੇ ਸਮਾਗਮ 'ਤੇ ਸਾਰੇ ਲੋਕ ਇਕੱਠੇ ਹੁੰਦੇ ਹਨ ਇੱਕ ਦੂਸਰੇ ਨੂੰ ਲ ਰੰਗ ਲਗਾਉਂਦੇ ਹਨ ਇੱਕ ਦੂਸਰੇ ਨੂੰ ਰੰਗ ਲਾ ਕੇ ਨੱਚਦੇ ਹਨ ਖੇਡਦੇ ਹਨ ਉੱਛਲਦੇ ਹਨ ਅਤੇ ਗੁਜੀਆ ਖਾਂਦੇ ਹਨ ਹੋਲੀ ਦਾ ਸਮਾਗਮ ਪੂਰਾ ਦਾ ਪੂਰਾ ਬਹੁਤ ਚੰਗਾ ਲੱਗਦਾ ਹੈ ਹੋਲੀ ਇੱਕ ਬਹੁਤ ਹੀ ਵੱਡਾ ਤਿਉਹਾਰ ਹੈ ਇਸ ਤਰ੍ਹਾਂ ਹੀ ਸਾਡੇ ਭਾਈਚਾਰੇ ਵਿੱਚ ਬਹੁਤ ਹੀ ਸਾਰੇ ਸਮਾਗਮ ਹੁੰਦੇ ਹਨ ਕਿੰਨਿਆਂ ਦੇ ਨਾਂ ਤੁਹਾਨੂੰ ਦੱਸੀਏ ਅਤੇ ਕਿੰਨਿਆਂ ਦੇ ਨਹੀਂ ਪਰ ਕੁਝ ਸਮਾਗਮ ਸਾਡੇ ਦਿਲ ਦੇ ਬਹੁਤ ਕਰੀਬ ਹੁੰਦੇ ਹਨ ਕਦੇ ਕਦੇ ਜੇ ਕੋਈ ਸਮਾਗਮ ਨਾ ਵੀ ਹੋਵੇ ਤਾਂ ਸਾਡੇ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਇੱਕ ਕੋਈ ਨਿੱਕਾ ਜਿਹਾ ਕਾਰਿਕ੍ਰਮ ਆਪੇ ਹੀ ਕਰਾ ਲੈਂਦੇ ਹਨ ਜਿਸ ਤਰ੍ਹਾਂ ਕੋਈ ਗਾਉਣ ਦੀ ਪ੍ਰਤੀਯੋਗੀਆਂ ਪ੍ਰਤੀਯੋਗਿਤਾ ਹੋ ਜਾਵੇ ਜਾਂ ਫਿਰ ਇਸ ਤਰ੍ਹਾਂ ਹੀ ਕੋਈ ਭੰਡਾਰਾ ਵਗੈਰਾ ਹੋ ਜਾਵੇ ਇਹ ਸਾਰੇ ਕਾਰਿਕ੍ਰਮਾਂ ਨਾਲ ਸਾਨੂੰ ਇਹ ਪਤਾ ਲੱਗਦਾ ਹੈ ਕਿ ਸਾਡਾ ਭਾਈਚਾਰਾ ਬਹੁਤ ਮਜ਼ਬੂਤ ਹੈ ਅਤੇ ਕਿ ਅਤੇ ਇਹਨਾਂ ਕਾਰਿਕ੍ਰਮਾਂ 'ਚ ਸਾਰਿਆਂ ਨੂੰ ਮਿਲ ਕੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਇਨਸਾਨ ਇੱਕ ਸੋਸ਼ਲ ਪ੍ਰਾਣੀ ਹੈ ਮਨੁੱਖ ਇੱਕ ਸੋਸ਼ਲ ਪ੍ਰਾਣੀ ਹੈ ਅਤੇ ਇਹ ਸੋਸ਼ਲਲੈੱਸ ਨੂੰ ਬਰਕਰਾਰ ਰੱਖਣ ਲਈ ਸਾਨੂੰ ਇਹਨਾਂ ਵਰਗੇ ਕਾਰਿਕ੍ਰਮਾਂ ਨੂੰ ਕਰਾਉਣਾ ਹੀ ਚਾਹੀਦਾ ਹੈ ਦਿਵਾਲੀ ਦੀ ਪਾਰਟੀ ਹੋਲੀ ਦੀ ਪਾਰਟੀ ਅਲੱਗ ਅਲੱਗ ਤਿਉਹਾਰਾਂ ਦੀ ਪਾਰਟੀ ਕੋਈ ਰਾਮਲੀਲਾ ਕੋਈ ਨਵਰਾਤਰੀ ਵਗੈਰਾ ਵਗੈਰਾ ਹੁੰਦੇ ਹੈ ਅਤੇ ਲੋਕ ਨਾਲ ਮਿਲ ਕੇ ਰਹਿੰਦੇ ਹਨ ਜੱਫੀਆਂ ਪਾਉਂਦੇ ਹਨ ਖੁਸ਼ ਰਹਿੰਦੇ ਹਨ